ਸਾਡੇ ਨਜ਼ਦੀਕ ਇੱਕ ਬਹੁਤ ਹੀ ਦਿਲਚਸਪ ਅਤੇ ਮਹੱਤਵਪੂਰਨ ਜਿਹੜਾ ਆ ਸਥਾਨ ਆ ਜਿਹਨੂੰ ਕਿ ਬਾਬਾ ਮਸਤੂ ਬੋਲਿਆ ਜਾਂਦਾ ਆ ਇਹ ਗੁਰਦੁਆਰਾ ਬਹੁਤ ਹੀ ਮਸ਼ਹੂਰ ਆ ਸਾਡੇ ਲਾਗੇ ਛਾਗੇ ਔਰ ਕਿਹਾ ਜਾਂਦਾ ਆ ਕਿ ਜਿਸ ਕਿਸੇ ਨੂੰ ਵੀ ਕੋਈ ਬਿਮਾਰੀ ਹੁੰਦੀ ਆ ਕੋਈ ਐਲਰਜੀ ਦੀ ਬਿਮਾਰੀ ਜਾਂ ਫਿਰ ਕੋਈ ਖਾਰਿਸ਼ ਦੇ ਨਾਲ ਰਿਲੇਟਡ ਕੋਈ ਵੀ ਬਿਮਾਰੀ ਹੁੰਦੀ ਆ ਉਹ ਇਸ ਗੁਰਦੁਆਰੇ ਦੇ ਤਲਾਅ ਦੇ ਵਿੱਚ ਜਦੋਂ ਇੱਕ ਵਾਰ ਨਹਾ ਲੈਂਦਾ ਆ ਤਾਂ ਉਸਦੀ ਹਰ ਪ੍ਰਕਾਰ ਦੀ ਬਿਮਾਰੀ ਔਰ ਰੋਗ ਦੂਰ ਹੋ ਜਾਂਦੇ ਨੇ ਸੋ ਇਹ ਹੀ ਸਾਡੇ ਇਲਾਕੇ ਦੇ ਸਾਡੇ ਖੇਤਰ ਦੇ ਜਿਹੜਾ ਆ ਇੱਕ ਖ਼ਾਸ ਸਥਾਨ ਆ ਜਿਹਨੂੰ ਕਿ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਨੇ ਅਤੇ ਇਸ਼ਨਾਨ ਕਰਨ ਆਉਂਦੇ ਨੇ